ਉਂਝ ਤਾਂ ਭਾਰਤ ਵਿੱਚ ਬਹੁਤ ਹੀ ਸਾਰੇ ਮਹੱਤਵਪੂਰਨ ਸਥਾਨ ਹਨ ਪਰ ਜਿਨ੍ਹਾਂ ਵਿੱਚੋਂ ਮੈਂ ਕੁਝ ਹੀ ਦੱਸਾਂਗੀ ਜਿਵੇਂ ਕਿ ਕੁੱਲੂ ਮਨਾਲੀ ਕੁੱਲੂ ਮਨਾਲੀ ਲੋਕ ਜ਼ਿਆਦਾਤਰ ਗਰਮੀਆਂ ਦੀ ਛੁੱਟੀਆਂ 'ਚ ਘੁੰਮਣ ਜਾਂਦੇ ਹਨ ਕਿਉਂਕਿ ਉੱਥੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਬਰਫ ਪੈਂਦੀ ਹੈ ਤਾਂ ਗਰਮੀਆਂ ਦੇ ਵਿੱਚ ਉੱਥੇ ਘੁੰਮਣਾ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਹੈ ਦੂਜਾ ਹੈ ਜੈਪੁਰ ਜੈਪੁਰ ਨੂੰ ਪਿੰਕ ਸਿਟੀ ਵੀ ਆਖਦੇ ਹਨ ਜੈਪੁਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਲਚਰ ਦੇਖਣ ਨੂੰ ਮਿਲਦੇ ਹਨ ਜੋ ਲੋਕਾਂ ਲਈ ਬਹੁਤ ਜ਼ਿਆਦਾ ਆਕਰਸ਼ਕ ਹੁੰਦੇ ਹਨ ਅਤੇ ਬਾਹਰ ਦੇ ਸੈਲਾਨੀ ਵੀ ਉਰੇ ਘੁੰਮਣ ਲਈ ਆਉਂਦੇ ਹਨ ਤੀਜਾ ਹੈ ਰਾਜਸਥਾਨ ਰਾਜਸਥਾਨ ਵਿੱਚ ਜ਼ਿਆਦਾਤਰ ਊਂਠ ਅਤੇ ਰੇਤ ਹੀ ਪਾਏ ਜਾਂਦੇ ਹਨ ਊਂਠਾਂ ਕਰਕੇ ਇਹ ਜ਼ਿਆਦਾ ਮਹੱਤਵਪੂਰਨ ਸਥਾਨ ਵਿੱਚ ਮੰਨਿਆ ਜਾਂਦਾ ਹੈ ਚ ਪੰਜਵਾਂ ਚੌਥਾ ਹੈ ਸਵਰਨ ਮੰਦਰ ਸਵਰਨ ਮੰਦਰ ਸੋਨੇ ਦਾ ਬਣਿਆ ਹੋਇਆ ਹੈ ਅਤੇ ਇਹ ਅੰਮ੍ਰਿਤਸਰ ਵਿੱਚ ਹੈ ਅਤੇ ਇਸ ਨੂੰ ਗੁਰੂ ਦੀ ਨਗਰੀ ਵੀ ਆਖਿਆ ਜਾਂਦਾ ਹੈ ਉਰੇ ਸਿੱਖਾਂ ਦੇ ਨਾਲ ਨਾਲ ਹੋਰ ਬਾਕੀ ਤਰ੍ਹਾਂ ਤਰ੍ਹਾਂ ਦੇ ਲੋਕ ਵੀ ਉਰੇ ਆਉਂਦੇ ਹਨ ਅਤੇ ਬਾਹਰ ਤੋਂ ਸੈਲਾਨੀ ਵੀ ਉਰੇ ਘੁੰਮਣ ਆਉਂਦੇ ਹਨ ਪੰਜਵਾਂ ਹੈ ਵਿਰਾਸਤ ਏ ਖਾਲਸਾ ਵਿਰਾਸਤ ਏ ਖਾਲਸਾ ਅਨੰਦਪੁਰ ਵਿੱਚ ਸਥਿਤ ਹੈ ਵਿਰਾਸਤ ਏ ਖਾਲਸਾ ਵਿੱਚ ਪੰਜਾਬ ਦੀ ਵਿਰਾਸਤ ਬਾਰੇ ਦੱਸਿਆ ਹੋਇਆ ਹੈ